ਮੈਂ ਬਹੁਤ ਸਾਰੀਆਂ ਵਰਕਸ਼ਾਪਾਂ ਲਾਈਆਂ ਹਨ ਜਿਸ ਵਿੱਚ ਮੈਂ ਔਨਲਾਈਨ ਵੀ ਲਾਈਆਂ ਅਤੇ ਔਫਲਾਈਨ ਵੀ ਲਗਾਈਆਂ ਹਨ ਅਤੇ ਕੁਛ ਕੁ ਮੈਂ ਘਰ ਵਾਲਿਆਂ ਤੋਂ ਸਿੱਖਿਆ ਹੈ ਗੱਲ ਕਰੀਏ ਯੂਟਿਊਬ ਦੀ ਤਾਂ ਯੂਟਿਊਬ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਬਣਾਉਣਾ ਜਿਸ ਵਿੱਚ ਕਿ ਬੇਸਣ ਦੀ ਬਰਫ਼ੀ ਅਤੇ ਸ਼ਾਹੀ ਪਨੀਰ ਮੈਂ ਸਭ ਤੋਂ ਵੱਧ ਬਣਾਇਆ ਏ ਜੋ ਕਿ ਘਰ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਅਤੇ ਮੈਨੂੰ ਬਾਰ ਬਾਰ ਬਣਾਉਣ ਲਈ ਕਹਿੰਦੇ ਰਹਿੰਦੇ ਹਨ ਜਿਵੇਂ ਕਿ ਬੇਸਣ ਦੀ ਬਰਫ਼ੀ 'ਚ ਉਹਨਾਂ ਨੇ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਬੇਸਣ ਨੂੰ ਘਿਓ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਉਸਨੂੰ ਬਰਾਊਨ ਕਰ ਲੈਣਾ ਹੈ ਅਤੇ ਇੱਕ ਪਾਸੇ ਚਾਸ਼ਣੀ ਤਿਆਰ ਕਰ ਲੈਣੀ ਹੈ ਜਿਸ ਵਿੱਚ ਕਿ ਪਾਣੀ ਪਾਉਣਾ ਏ ਅਤੇ ਚੀਨੀ ਪਾਉਣੀ ਹੈ ਅਤੇ ਉਹ ਤਿਆਰ ਕਰ ਕੇ ਜਦੋਂ ਬੇਸਣ ਚੰਗੀ ਤਰ੍ਹਾਂ ਭੁੰਨ ਹੋਜੂ ਹੋ ਜਾਵੇਗਾ ਤਾਂ ਉਹਨਾਂ ਨੂੰ ਮਿਕਸ ਕਰ ਦੇਣਾ ਏ ਅਤੇ ਮਿਕਸ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਬਰਤਨ 'ਚ ਪਾ ਕੇ ਸੈੱਟ ਕਰਕੇ ਰੱਖ ਦੇਣਾ ਏ ਅਤੇ ਉਸ ਤੋਂ ਬਾਅਦ ਫਰਿੱਜ ਵਿੱਚ ਲਾ ਦੇਣਾ ਏ ਅਤੇ ਦੋ ਘੰਟੇ ਬਾਅਦ ਉਸਨੂੰ ਕੱਢ ਕੇ ਉਸਨੂੰ ਕੱਟ ਲੈਣਾ ਏ ਉਹਦੇ ਪੀਸ ਬਣਾ ਲੈਣੇ ਹਨ ਇਸ ਤਰ੍ਹਾਂ ਬਰਫ਼ੀ ਤਿਆਰ ਹੋ ਜਾਂਦੀ ਹੈ ਅਤੇ ਮੈਂ ਬਹੁਤ ਵਾਰ ਬਣਾਈ ਆਪਣੇ ਘਰਦਿਆਂ ਦੇ ਕਹਿਣ 'ਤੇ ਵੀ ਬਣਾਈ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਅਤੇ ਇੱਕ ਸ਼ਾਹੀ ਪਨੀਰ ਉਹ ਵੀ ਮੈਂ ਬਹੁਤ ਵਾਰ ਯੂਟਿਊਬ ਤੋਂ ਦੇਖ ਕੇ ਬਣਾਇਆ ਏ ਉਸ ਵਿੱਚ ਪਹਿਲਾਂ ਗ੍ਰੇਵੀ ਤਿਆਰ ਕਰਨੀ ਹੈ ਜਿਵੇਂ ਕਿ ਲਸਣ ਪਿਆਜ਼ ਅਤੇ ਅਦਰਕ ਸਾਰਾ ਪੇਸਟ ਤਿਆਰ ਕਰ ਕੇ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਹਨ ਜਿਵੇਂ ਕਿ ਕਾਜੂ ਮਲ਼ਾਈ ਦੁੱਧ ਅਤੇ ਪਨੀਰ ਅਤੇ ਉਹ ਵੀ ਮੈਂ ਬਹੁਤ ਵਾਰੀ ਬਣਾਇਆ ਹੈ ਅਤੇ ਇਹ ਦੋ ਚੀਜ਼ਾਂ ਮੈਂ ਯੂਟਿਊਬ ਤੋਂ ਸਿੱਖ ਕੇ ਬਹੁਤ ਵਾਰ ਬਣਾਈਆਂ ਹਨ